ਜੀ ਹਾਂ ਮੈਂ ਮੈਰਾਥਨ ਜਾਂ ਹੋਰ ਲੰਬੀ ਦੂਰੀ ਦੀ ਦੌੜ ਵਿੱਚ ਹਿੱਸਾ ਲਿਆ ਹੈ ਅੱਜ ਤੋਂ ਤਕਰੀਬਨ ਚਾਰ ਸਾਲ ਪਹਿਲੇ ਸਾਡੀ ਡੀ ਸੀ ਜਦੋਂ ਈਸ਼ਾ ਕਾਲੀਆ ਮੈਮ ਹੁੰਦੇ ਸੀ ਤਾਂ ਉਹਨਾਂ ਨੇ ਇੱਕ ਮੈਰਾਥਨ ਦੌੜ ਲਗਵਾਈ ਸੀ ਵੋਟਰ ਦੇ ਦੇ ਸੰਬੰਧ ਵਿੱਚ ਉਦੋਂ ਮੈਂ ਇਸ ਦੌੜ ਵਿੱਚ ਹਿੱਸਾ ਲਿਆ ਸੀ ਸਹੀ ਦੌੜ ਦੀ ਤਿਆਰੀ ਮੈਂ ਹਫ਼ਤਾ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ ਮੈਂ ਆਪਣੇ ਦੋਸਤਾਂ ਦੇ ਨਾਲ ਸ਼ਾਮ ਨੂੰ ਗਰਾਊਂਡ ਦੇ ਵਿੱਚ ਜਾਂਦਾ ਕਿਉਂਕਿ ਮੇਰਾ ਭੱਜਣਾ ਮੇਰੀ ਹੋਬੀ ਹੈ ਮੇਰਾ ਸ਼ੌਂਕ ਹੈ ਤਾਂ ਮੈਂ ਇਹਦੀ ਤਿਆਰੀ ਵਾਸਤੇ ਹਫ਼ਤਾ ਪਹਿਲੇ ਹੀ ਤਿਆਰੀ ਸ਼ੁਰੂ ਕਰ ਦਿੱਤੀ ਮੈਂ ਉਹਦੇ ਵਾਸਤੇ ਇੱਕ ਕਿਲੋਮੀਟਰ ਦੋ ਕਿਲੋਮੀਟਰ ਤਿੰਨ ਕਿਲੋਮੀਟਰ ਇਹ ਕੀ ਹੈ ਹੌਲੀ ਭੱਜਣਾ ਸ਼ੁਰੂ ਕੀਤਾ ਦੌੜਦੇ ਦੌੜਦੇ ਮੈਂ ਪੰਜ ਸੱਤ ਦਸ ਕਿਲੋਮੀਟਰ ਦੀ ਪ੍ਰੈਕਟਿਸ ਤਾਂ ਪੰਜ ਸੱਤ ਦਸ ਕਿਲੋਮੀਟਰ ਦੀ ਪ੍ਰੈਕਟਿਸ ਕੀਤੀ ਅਤੇ ਮੈਂ ਆਪਣਾ ਆਪਣਾ ਜਨੂੰਨ ਬਣਾ ਲਿਆ ਕਿ ਮੈਂ ਮੈਰਾਥਨ ਦੌੜ ਵਿੱਚ ਪਾਰਟੀਸਪੇਟ ਕਰਨਾ ਭਾਗ ਲੈਣਾ ਅਤੇ ਮੈਨੂੰ ਜਿੱਤਣਾ ਵੀ ਹੈਗਾ ਜਿਸ ਦਿਨ ਮੈਰਾਥਨ ਦੌੜ ਸ਼ੁਰੂ ਹੋਣੀ ਸੀ ਉਸ ਦਿਨ ਮੈਂ ਸਵੇਰੇ ਉਠਿਆ ਮੈਂ ਆਪਣੇ ਆਪ ਸਰੀਰ ਨੂੰ ਵਰਜਿਸ਼ ਕੀਤਾ ਦੰਡ ਬੈਠਕਾਂ ਕੱਢੀਆਂ ਅਤੇ ਮੈਂ ਆਪਣੇ ਆਪ ਸਰੀਰ ਨੂੰ ਤਿਆਰ ਪੂਰੀ ਤਰ੍ਹਾਂ ਕਰ ਲਿਆ ਮੈਰਾਥਨ ਦੌੜ ਸ਼ਾਮੀਂ ਪੰਜ ਵਜੇ ਸ਼ੁਰੂ ਹੋਣੀ ਸੀ ਜਦੋਂ ਸ਼ਾਮੀਂ ਪੰਜ ਵਜੇ ਮੈਰਾਥਨ ਦੌੜ ਸ਼ੁਰੂ ਹੋਈ ਤਾਂ ਸਾਰੇ ਪਾਰਟੀਸਪੈਂਟਸ ਸਾਰੇ ਭਾਗ ਲੈਣ ਵਾਲੇ ਉੱਥੇ ਪਹੁੰਚੇ ਹੋਏ ਸੀ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਅਤੇ ਏ ਡੀ ਸੀ ਐਸ ਐਸ ਪੀ ਆਫਿਸ ਵਾਲੇ ਹੋਰ ਦਫ਼ਤਰਾਂ ਦੇ ਸਟਾਫ ਅਤੇ ਹੋਰ ਵੀ ਜੋ ਲੋਕ ਜਿਹਨਾਂ ਨੇ ਇਹਦੇ ਵਿੱਚ ਭਾਗ ਲੈਣਾ ਸੀ ਉਹ ਸਾਰੇ ਹੀ ਪਹੁੰਚੇ ਹੋਏ ਸੀ ਜਦੋਂ ਡੀ ਸੀ ਮੈਮ ਨੇ ਹਰੀ ਝੰਡੀ ਵਿਖਾਈ ਤਾਂ ਕੀ ਹੈ ਮੈਰਾਥਨ ਦੌੜ ਸ਼ੁਰੂ ਹੋ ਗਈ ਡੀ ਸੀ ਮੈਮ ਖੁਦ ਵੀ ਸਾਡੇ ਨਾਲ ਭੱਜ ਰਹੇ ਸੀ ਅਸੀਂ ਸਾਰੇ ਉਹਨਾਂ ਦੇ ਨਾਲ ਭੱਜ ਰਹੇ ਸੀ ਤਾਂ ਇਹ ਦੌੜ ਸ਼ੁਰੂ ਹੋਈ ਜ਼ਿਲ੍ਹੇ ਦੇ ਡੀ ਸੀ ਕਾਰਆਲਿਆ ਤੋਂ ਸ਼ੁਰੂ ਹੋ ਕੇ ਇਹ ਆਸਫ ਵਾਲਾ ਜਿੱਥੇ ਸ਼ਹੀਦਾਂ ਦੀ ਵਾਰ ਹੈ ਉੱਥੇ ਤੱਕ ਜਾਣੀ ਸੀ ਤਾਂ ਜਦੋਂ ਇਹ ਸ਼ੁਰੂ ਹੋਈ ਹੌਲੀ ਹੌਲੀ ਸਾਰੇ ਭੱਜਦੇ ਗਏ ਭੱਜਦੇ ਭੱਜਦੇ ਇਹ ਮੈਰਾਥਨ ਦੌੜ ਚਲਦੀ ਰਹੀ ਇਹ ਸ਼ੁਰੂ ਹੋ ਕੇ ਆਸਫ ਵਾਲਾ ਤੱਕ ਪਹੁੰਚੀ ਆਸਫ ਵਾਲਾ ਪਹੁੰਚ ਕੇ ਇਹ ਦੌੜ ਕੀ ਹੈ ਖ਼ਤਮ ਹੋਈ ਅਤੇ ਡੀ ਸੀ ਮੈਮ ਨੇ ਉੱਥੇ ਜਾ ਕੇ ਦੌੜ ਨੂੰ ਕੀ ਕੀਤਾ ਖ਼ਤਮ ਕੀਤਾ ਇਹ ਦੌੜ ਮੇਰਾ ਬਹੁਤ ਵੱਡਾ ਐਕਸਪੀਰੀਅੰਸ ਰਿਹਾ ਇਹਨੇ ਮੈਨੂੰ ਬੜਾ ਕੁਝ ਸਿਖਾਇਆ ਮੇਰਾ ਸਰੀਰ ਦਾ ਮੈਨੂੰ ਐਂ ਲੱਗਿਆ ਕਿ ਵਾਕਆ ਹੀ ਮੈਂ ਇਹ ਦੌੜ ਦੌੜ ਸਕਦਾ ਹਾਂ ਅਤੇ ਮੈਂ ਇਹ ਦੌੜ ਦੌੜ ਕੇ ਜਿੰਨੇ ਵੀ ਲੋਕਾਂ ਨੇ ਇਹ ਦੌੜ ਨੂੰ ਦੌੜਿਆ ਉਹ ਸਾਰੇ ਹੀ ਬੜੇ ਜ਼ਿਆਦਾ ਖੁਸ਼ ਹੋਏ ਅਤੇ ਬੜਾ ਜ਼ਿਆਦਾ ਇੰਜੋਏ ਕੀਤਾ